ਹੈਲੋ ਹੈਲੋ ਹਾਂਜੀ ਅਸੀਂ ਬਰਨਾਲੇ ਤੋਂ ਬੋਲਦੇ ਸੀ ਅਤੇ ਅਸੀਂ ਪਲਾਟ ਲੈਣਾ ਸੀਗਾ ਤੁਸੀਂ ਪ੍ਰੋਪਰਟੀ ਡੀਲਰ ਬੋਲਦੇ ਹੋ ਜੀ ਹਾਂਜੀ ਅਸੀਂ ਪਲੋਟ ਲੈਣਾ ਸੀਗਾ ਅਤੇ ਜਾਂ ਕੋਈ ਰੈਂਟ 'ਤੇ ਮਿਲਜੇ ਸਾਨੂੰ ਥੋੜ੍ਹੀ ਐਡਵਾਈਸ ਦਿਓਂਗੇ ਹਾਂਜੀ ਹਾਂਜੀ ਅਸੀਂ ਟਰਾਂਸਫਰ ਕਰਵਾ ਕੇ ਆਏ ਹਾਂ ਨਾਲ ਰਹਿੰਦੀ ਬਸ ਸਟੈਂਡ ਦੇ ਕੋਲ ਬਾਈ ਏਕੜ 'ਚ

ਲੋਕੇਸ਼ਨ ਵਧੀਆ ਹੋਵੇ ਜੀ ਵੀ ਮਤਲਬ ਫੈਮਲੀ ਵਾਲਾ ਹੋਵੇ ਸਾਰਾ ਉੱਥੇ ਏਰਿਯਾ ਅਤੇ ਬਸ ਪੋਲੂਉਸਨ ਵਗੈਰਾ ਥੋੜ੍ਹੀ ਘੱਟ ਹੋਵੇ ਸੜਕਾਂ ਵਗੈਰਾ ਵਧੀਆ ਹੋਣ ਹਾਂਜੀ ਹਾਂਜੀ

ਨਾਲ ਹੀ ਹੈ ਜੀ

ਅਸੀਂ ਚਾਰੇ ਮੈਂਬਰ ਹੈ ਹਾਂਜੀ ਹਾਂਜੀ ਅਤੇ ਬਸ ਪਲਾਂਟ ਵੀ ਬਾਹਲਾ ਜ਼ਿਆਦਾ ਵੀ ਰੇਟ ਨਾ ਹੋਵੇ ਵੀ ਬਾਹਲਾ ਬਸ ਠੀਕ ਹੀ ਹੋਵੇ ਸਾਡੇ ਆਪਣੇ ਬਜਟ ਦੇ ਅਕੋਰਡਿੰਗ ਲੈ ਸਕੀਏ ਹਾਂਜੀ ਸਾਡਾ ਹੈਗਾ ਜੀ ਪੰਜ ਕੁ ਲੱਖ ਦਾ ਹੀ ਹੈ ਇਸ ਤੋਂ ਵੱਧ ਨਹੀਂ ਹੈਗਾ ਹਾਂਜੀ ਹਾਂਜੀ ਹਾਂਜੀ ਅਸੀਂ ਪਹਿਲਾਂ ਰੈਂਟ 'ਤੇ ਹੀ ਰਹਿ ਕੇ ਦੇਖ ਲਾਂਗੇ ਜੀ ਸਾਨੂੰ ਏਰੀਏ ਦਾ ਪਤਾ ਲੱਗਜੂ ਵੀ ਕਿਵੇਂ ਆ ਕਿਵੇਂ ਨਹੀਂ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅਸੀਂ ਆ ਕੇ ਆਫਿਸ 'ਚ ਮਿਲ ਲਾਂਗੇ ਜੀ ਫਿਰ ਹਾਂਜੀ ਹਾਂਜੀ ਠੀਕ ਹੈ ਹਾਂਜੀ ਰੈਂਟ 'ਤੇ ਹੀ ਦੇਖ ਕੇ ਦੇਖਾਂਗੇ ਜੀ ਫਿਰ ਅਸੀਂ ਆ ਕੇ ਥੈਂਕ ਯੂ ਠੀਕ ਹੈ ਜੀ ਠੀਕ ਹੈ ਥੈਂਕ ਯੂ